ਸਾਡੇ ਸਥਾਨਕ ਕਲਾਕਾਰ ਅਤੇ ਸ਼ਿਲਪਕਾਰ ਹਰ ਸਾਲ ਸਾਡੇ ਖੇਤਰ ਦੇ ਲੋਕਾਂ ਅਤੇ ਔਰਤਾਂ ਲਈ ਸਿਲਾਈ ਸਿਖਲਾਈ ਕੈਂਪ ਆਯੋਜਿਤ ਕਰਦੇ ਹਨ ਜਿਸ ਵਿੱਚ ਸਾਰੀਆਂ ਔਰਤਾਂ ਨੂੰ ਮੁਫਤ ਸਿਲਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਸ ਕੈਂਪ ਵਿੱਚ ਔਰਤਾਂ ਦੇ ਨਾਲ ਨਾਲ ਮਰਦ ਮਰਦ ਵੀ ਸ਼ਾਮਲ ਹੋ ਸਕਦੇ ਹਨ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਖੇਤਰ ਦੇ ਸਾਰੇ ਲੋਕਾਂ ਅਤੇ ਸਾਰੀਆਂ ਔਰਤਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜਿਹੜੇ ਲੋਕ ਅਤੇ ਜੋ ਵੀ ਇਨਸਾਨ ਚਾਹਵਾਨ ਹੁੰਦੇ ਹਨ ਉਹ ਉਸ ਕੈਂਪ ਦੇ ਸੰਚਾਲਕ ਨੂੰ ਆਪਣਾ ਨਾਮ ਦੇ ਦਿੰਦੇ ਹਨ ਮੈਂ ਇਸ ਕੈਂਪ ਦਾ ਹਿੱਸਾ ਬਣਨ ਅਤੇ ਇਸਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮਾਤਾ ਜੀ ਆਪਣੇ ਮਾਤਾ ਜੀ ਨਾਲ ਸਲਾਹ ਕਰਾਂਗੀ ਅਤੇ ਉਸ ਤੋਂ ਬਾਅਦ ਕੈਂਪ ਵਿੱਚ ਸਿਖਲਾਈ ਸਿੱਖਾਂਗੀ